ਮੈਂ ਕੀ ਬਣਾਉਣਾ ਹੈ ਇਹ ਫ਼ੈਸਲਾ ਤਾਂ ਮੈਂ ਆਪਣੇ ਟੋਪਿਕ ਦੇ ਅਕੋਰਡਿੰਗ ਕਰਦੀ ਹਾਂ ਹੁਣ ਮੈਂ ਬੱਚੇ ਨੂੰ ਕੀ ਸਮਝਾਉਣਾ ਚਾਹੁੰਦੀ ਹਾਂ ਠੀਕ ਹੈ ਜੇ ਮੈਂ ਬੱਚੇ ਨੂੰ ਫ਼ਲਾਂ ਬਾਰੇ ਸਮਝਾਣਾ ਹੈ ਤਾਂ ਮੈਂ ਉਸਦੇ ਫ਼ਲ ਦੇ ਚਿੱਤਰ ਬਣਾਉਂਗੀ ਕਿ ਇਸ ਚਿੱਤਰ ਦੇ ਨਾਲ ਇਸ ਰੰਗ ਦੇ ਨਾਲ ਬੱਚੇ ਨੂੰ ਸਮਝਾਇਆ ਜਾ ਸਕੇ ਸੇਬ ਕੇਲਾ ਅੰਗੂਰ ਸੰਤਰੇ ਅਨਾਨਾਸ ਇਹ ਸਾਰੇ ਚਿੱਤਰ ਬਣਾਵਾਂਗੇ ਅਤੇ ਇਸਦੇ ਵਿੱਚ ਅਲੱਗ ਅਲੱਗ ਰੰਗ ਭਰਾਂਗੇ ਅਤੇ ਉਸਦੇ ਅਨੁਸਾਰ ਮੈਂ ਉਹਨਾਂ ਨੂੰ ਫ਼ਲ ਵੀ ਦੱਸ ਸਕਦੀ ਹੈ ਅਤੇ ਉਹਨਾਂ ਨੂੰ ਫ਼ਲ ਦਾ ਕੀ ਰੰਗ ਹੈ ਰੰਗ ਵੀ ਦੱਸ ਸਕਦੀ ਹਾਂ ਇੱਕ ਚਿੱਤਰ ਨਾਲ ਮੇਰੇ ਦੋ ਕਾਰਜ ਹੋ ਜਾਂਦੇ ਹੈ ਹੁਣ ਮੇਰੇ ਕੋਲ ਖ਼ਾਸ ਵਿਸ਼ੇ 'ਤੇ ਇਹ ਹੀ ਹੈ ਥੀਮ ਤਾਂ ਮੇਰੇ ਕੋਲ ਇਹ ਹੀ ਹੈ ਕਿ ਮੈਂ ਆਪਣੇ ਬੱਚੇ ਨੂੰ ਕੀ ਸਮਝਾਉਣਾ ਚਾਹੁੰਦੀ ਹਾਂ ਜੋ ਮੈਂ ਉਸਨੂੰ ਸਮਝਾਉਣਾ ਚਾਹੁੰਦੀ ਹਾਂ ਜਿਸ ਬਾਰੇ ਮੈਂ ਉਸਨੂੰ ਗਿਆਨ ਦੇਣਾ ਚਾਹੁੰਦੀ ਹਾਂ ਉਸਤੋਂ ਰਿਲੇਟਿਡ ਹੀ ਮੈਂ ਕੁਛ ਨਾ ਕੁਛ ਚਿੱਤਰ ਬਣਾਉਂਗੀ